ਅਠਾਰਾਂ ਜਨਵਰੀ ਦੋ ਹਜ਼ਾਰ ਤਿੰਨ ਅਠਾਈ ਨਵੰਬਰ ਦੋ ਹਜ਼ਾਰ ਵੀਹ ਪੰਦਰਾਂ ਮਾਰਚ ਦੋ ਹਜ਼ਾਰ ਤੇਈ ਚੌਦਾਂ ਅਗਸਤ ਦੋ ਹਜ਼ਾਰ ਉੱਨੀ ਚੌਦਾਂ ਫਰਵਰੀ ਦੋ ਹਜ਼ਾਰ ਉੱਨੀ